ਸਾਡੇ ਖੇਤਰ ਵਿੱਚ ਕਲਾਕਾਰ ਅਤੇ ਸ਼ਿਲਪਕਾਰ ਕੋਚਿੰਗ ਸੈਂਟਰ ਖੋਲ੍ਹ ਕੇ ਸਿਖਲਾਈ ਦਿੰਦੇ ਹਨ ਮੈਂ ਮਿਊਜਿਕ ਸਿੱਖਣਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਖੇਤਰ ਦੇ ਵਿੱਚ ਕੰਮ ਕਰਦੇ ਲੋਕਾਂ ਤੋਂ ਇਸ ਬਾਰੇ ਸਲਾਹ ਲੈ ਕੇ ਕਿਸੇ ਅੱਛੇ ਮਿਊਜ਼ਿਕ ਸਿਖਲਾਈ ਕੇਂਦਰ ਵਿੱਚ ਦਾਖਲਾ ਲਵਾਂਗੀ